ਮੱਕੀ ਦੀ ਰੋਟੀ ਜਿਸਦੇ ਵਿੱਚ ਕਿ ਮੂਲੀ ਅਤੇ ਮੇਥੇ ਪਾਏ ਹੋਏ ਹੋਣ ਨਾਲ ਹਰੀ ਮਿਰਚ ਹੋਵੇ ਦਹੀਂ ਦੇ ਨਾਲ ਅਤੇ ਮੱਖਣ ਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਕਿਉਂਕਿ ਇਹ ਅਨਰਜੀ ਦਿੰਦੀ ਆ ਸਾਨੂੰ ਸਾਡੇ ਸਰੀਰ ਨੂੰ ਇਹ ਸਟਰੋਂਗ ਕਰਦੀ ਆ ਇਹਨੂੰ ਖਾ ਕੇ ਸਾਡਾ ਜਿਹੜਾ ਮਨ ਆ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ